ਹੈਲੋ ਹਾਂਜੀ ਹਾਂਜੀ ਬੋਲ ਰਿਹਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹੂੰ ਹੂੰ ਹੂੰ ਮਾਨਸਾ ਦੇ ਗੁਰਦੁਆਰਾ 'ਚ ਇੱਕ ਤਾਂ ਤੁਹਾਡਾ ਭੀਖੀ ਲਈ ਜਾਂਦਾ ਉੱਥੇ ਨੌਵੀਂ ਪਾਤਸ਼ਾਹ ਜੀ ਆਏ ਸੀਗੇ ਧਰਮ ਪਰਿਵਰਤਨ ਰੋਕਣ ਵਾਸਤੇ ਇੱਥੋਂ ਦੀ ਬੜੀ ਖਾਸੀਅਤ ਇਹ ਹੈ ਵੀ ਉੱਥੇ ਕਿ ਹਿੰਦੂ ਵੀ ਸਿੱਖ ਬਣੇ ਹੋਏ ਨੇ ਜਿਵੇਂ ਕਿ ਲਾਲੇ ਆਪਣੇ ਨਾਮ ਦੇ ਪਿੱਛੇ ਸਿੰਘ ਲਿਖਦੇ ਨੇ ਬੜਾ ਇਤਿਹਾਸਿਕ ਗੁਰਦੁਆਰਾ ਬੜਾ ਸਰੋਵਰ ਬਣਿਆ ਹੋਇਆ ਅਤੇ ਅੱਜ ਕੱਲ੍ਹ ਉਹਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਸਾਂਭ ਰਹੀ ਹੈ ਉਸ ਤੋਂ ਬਾਅਦ ਜੇ ਮਾਨਸਾ ਦੀ ਗੱਲ ਕਰੀਏ ਮਾਨਸਾ ਦੇ ਵਿੱਚ ਮੇਨ ਜਿਹੜਾ ਆਪਣਾ ਬਾਜ਼ਾਰ ਹੈ ਉਹਦੇ ਵਿੱਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੇ ਨਾਲ ਹੀ ਸਾਰੀ ਮਾਰਕੀਟ ਹੈ ਅਤੇ ਨਾਲ ਹੀ ਉੱਥੇ ਨੇੜੇ ਇੱਕ ਦੋਦੜਾ ਪੈ ਜਾਂਦਾ ਉੱਥੇ ਵੀ ਬਹੁਤ ਸ਼ਾਨਦਾਰ ਗੁਰਦੁਆਰਾ ਚੋਵੀ ਘੰਟੇ ਲੰਗਰ ਚੱਲਦਾ ਉੱਥੇ ਇੱਕੇ ਬਾਕੀ ਮਾਨਸਾ 'ਚ ਭਾਈ ਗੁਰਦਾਸ ਹੈ ਭਾਈ ਗੁਰਦਾਸ ਜੀ ਦਾ ਗੁਰਦੁਆਰਾ ਉੱਥੇ ਜਿਹੜੇ ਬੱਚੇ ਬੋਲਦੇ ਨਹੀਂ ਉੱਥੇ ਤੋਤੇ ਚੜਾ ਦਿੰਦੇ ਨੇ ਅਤੇ ਕਹਿੰਦੇ ਉੱਥੇ ਲੋਕਾਂ ਦੀਆ ਸੁੱਖਾਂ ਆਉਂਦੀਆਂ ਸਾਰੀਆਂ ਅਤੇ ਪਾਣੀ ਵੀ ਪਿਲਾਇਆ ਜਾਂਦਾ ਉੱਥੇ ਹਾਂ ਉਹ ਪਾਣੀ ਪਿਲਾਇਆ ਜਾਂਦਾ ਜਿਹਦੇ ਨਾਲ ਤੇ ਬੱਚੇ ਜਿਹੜੇ ਬੋਲਦੇ ਨਹੀਂ ਉਹ ਸਾਰੇ ਠੀਕ ਬੜਾ ਵਿਸ਼ਾਲ ਮੇਲਾ ਲੱਗਦਾ ਉੱਥੇ ਜਾ ਕੇ ਤੁਸੀਂ ਆਓ ਤੁਹਾਨੂੰ ਦਿਖਾਵਾਂਗੇ ਉੱਥੇ ਨਾਲੇ ਦਰਸ਼ਨ ਕਰਾ ਅਤੇ ਬੜੇ ਪ੍ਰਸਿੱਧ ਉੱਥੋਂ ਦੇ ਰਹਿੰਦੇ ਨੇ ਉੱਥੇ ਅਤੇ ਉੱਥੇ ਨਾਲ ਹੀ ਹੈ ਗੁਰੂਦੁਆਰਾ ਸਾਹਿਬ ਉੱਥੇ ਵੀ ਪਸ਼ੂਆਂ ਦੇ ਕਿੱਲੇ ਚੜਦੇ ਨੇ ਜਿਹਦੇ ਨਾਲ ਕਿ ਬਿਮਾਰ ਬਮੁਰ ਹੋ ਜਾਂਦੇ ਉਹ ਵੀ ਕਦੋਂ ਆਉਣਾ ਹੈ ਚੱਲੋ ਠੀਕ ਹੈ ਜੀ ਓਕੇ ਜੀ